ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਭਾਅ ਜੀ ਭਾਅ ਜੀ ਦੇਖੋ ਜੇ ਤਾਂ ਤੁਸੀਂ ਘੁੰਮਣਾ ਤਾਂ ਫਿਸ਼ ਪਾਰਕ ਬੜੀ ਮਾੜੀ ਜਗ੍ਹਾ ਜੇ ਕਿਉਂਕਿ ਮੈਂ ਤੁਹਾਨੂੰ ਪੂਰਾ ਰਿਕਾਰਡ ਦੱਸਣਾ ਉਹਦਾ ਕੀ ਸਿਸਟਮ ਪਾਣੀ ਆ ਸਵੇਰੇ ਮੈਂ ਗਿਆ ਸਰਕਾਰੀ ਸਕੂਲ ਦੇ ਨਿਆਣੇ ਮਾਰਦੇ ਬੰਕ ਫਿਰ ਉਹ ਵੜ ਜਾਂਦੇ ਆਪਣੇ ਫਿਸ਼ ਪਾਰਕ ਉੱਥੇ ਫਿਰ ਮੈਂ ਕਿਹਾ ਭਾਅ ਜੀ ਨਸ਼ਾ ਕਰਦੇ ਤੁਸੀਂ ਪੁੱਛੋ ਕੁਝ ਨਾ ਮੈਂ ਕਿਹਾ ਦੁਪਹਿਰੀ ਇੱਥੇ ਆਉਂਦੇ ਆਸ਼ਕ ਆਸ਼ਕ ਆਉਂਦੇ ਉੱਤੇ ਸ਼ਰੇਆਮ ਹੀ ਪੱਪੀਆਂ ਹੁੰਦੀਆਂ ਚੁੰਮਾ ਚਾਟੀ ਚੱਲਣਡੀਆ ਠੀਕ ਆ ਫਿਰ ਉੱਥੇ ਆਉਂਦੀ ਪੁਲਿਸ ਤੁਹਾਡੇ ਵਰਗਾ ਕੋਈ ਸ਼ਰੀਫ ਬੰਦਾ ਵੈਸੇ ਘੁੰਮਣ ਹੀ ਗਿਆ ਹੋਵੇ ਉੱਥੇ ਤੇ ਤੁਸੀਂ ਰਗੜੇ ਗਏ ਨਾ ਫਿਰ ਉਹਨਾਂ ਨੂੰ ਤਾਂ ਸ਼ੱਕ ਪੈਣਾ ਕਿ ਇਹ ਭੰਗ ਮਲਣ ਆਇਆ ਉੱਥੇ ਨਹੀਂ ਜਾਣਾ ਉਹ ਘੁੰਮਣ ਨੂੰ ਕੋਈ ਜਗ੍ਹਾ ਵਧੀਆ ਹੈ ਨਹੀਂ ਸਵੇਰੇ ਨਿਆਣੇ ਨਸ਼ੇ ਕਰਦੇ ਆ ਦੁਪਹਿਰੀ ਉੱਥੇ ਆਸ਼ਕੀ ਹੋ ਜਾਂਦੀ ਸ਼ਾਮੀ ਉੱਥੇ ਬੁੱਢੇ ਸੈਰ ਕਰਦੇ ਆ ਉਹ ਵੀ ਆਪਸ 'ਚ ਲੱਗੇ ਰਹਿੰਦੇ ਨਿਆਣਿਆਂ ਨਾਲ ਹੀ ਹਾਂਜੀ ਭਾਅ ਜੀ ਕਿਤੇ ਹੋਰ ਘੁੰਮੋ ਭਾਅ ਜੀ ਪੰਡੋਰੀ ਵੱਲ ਜਾਓ ਕਿਤੇ ਰੱਬ ਦੇ ਘਰ ਘੁੰਮੋ ਠੀਕ ਆ ਭਾਅ ਜੀ ਬਾਏ ਬਾਏ